ਕੋਰਸ ਏ ਬੀ ਏ ਬੀ ਪਲਸ ਬੀ ਇਹ ਕੋਰਸ ਕੰਪੂਟਰ ਬਾਰੇ ਸਿਖਾਉਂਦੇ ਹਨ ਤਾਂ ਇਹ ਹੁਣ ਕੁਝ ਏ ਟੀ ਦੇ ਵੀ ਸ਼ੁਰੂ ਹੋ ਗਏ ਹਨ ਕੰਪੂਟਰ ਸਕੂਲਾਂ ਵਿੱਚ ਕਰਵਾਏ ਜਾਂਦੇ ਹੈ ਪਰ ਇਹ ਪ੍ਰੈਕਟੀਕਲ ਨਹੀਂ ਦਿਖਾਉ ਦਿਖਾਉਂਦੇ ਦਿਖਾਉਂਦੇ ਹੁਣ ਇਹ ਹੁਣ ਸਾਨੂੰ ਸਾਡੇ ਬੱਚਿਆਂ ਨੂੰ ਸਕੂਲਾਂ ਵਿੱਚ ਕੰਪੂਟਰ ਬਾਰੇ ਦੱਸਣਾ ਚਾਹੀਦਾ ਹੈ ਅਤੇ ਕਰਾਉਣਾ ਚਾਹੀਦਾ ਹੈ ਅਤੇ ਇਹ ਪ੍ਰੈਟੀਕਲ ਕਰਾਉਣਾ ਕਰਾਉਣੇ ਚਾਹੀਦੇ ਹਨ ਅਤੇ ਜ਼ਰੂਰ ਕਰਵਾਏ ਜਾਣ